ਹੈਲੋ ਹਾਂਜੀ ਮੈਮ ਅੱਛਾ ਤੁਸੀਂ ਹੁਸ਼ਿਆਰਪੁਰ ਇਹ ਕਿੰਨੇ ਦਿਨ ਲਈ ਆਏ ਹੋ ਵੈਸੇ ਹੁਸ਼ਿਆਰਪੁਰ ਆ ਗਏ ਹੋ ਜਾਂ ਆਉਣਾ ਹਲੇ ਅੱਛਾ ਮਤਲਬ ਕਿੰਨੇ ਕੁ ਬੰਦੇ ਹੋ ਤੁਸੀਂ ਕਿੰਨੇ ਕੁ ਬੰਦੇ ਹੋ ਤੁਸੀਂ ਤਿੰਨ ਬੰਦੇ ਮਤਲਬ ਤੈਨੂੰ ਮਤਲਬ ਵੈਜੀਟੇਰੀਅਨ ਚਾਹੀਦਾ ਕਿ ਨੋਨ ਵੈਜੀਟੇਰੀਅਨ ਨੇ ਜੀ ਨਹੀਂ ਤੁਹਾਨੂੰ ਵੈਜੀਟੇਰੀਅਨ ਚਾਹੀਦਾ ਕਿ ਨੋਨ ਵੈਜੀਟੇਰੀਅਨ ਅੱਛਾ ਵੈਜੀਟੇਰੀਅਨ ਵੈਜੀਟੇਰੀਅਨ ਫੂਡ ਹੈਗੇ ਆ ਹੁਸ਼ਿਆਰਪੁਰ ਬਹੁਤ ਵਧੀਆ ਜਗ੍ਹਾ ਮਤਲਬ ਤਿੰਨ ਬੰਦੇ ਤਿੰਨ ਬੰਦੇ ਹਾਂ ਤੁਸੀਂ ਜਾ ਸਕਦੇ ਹੋ ਇੱਥੇ ਜਨਤਾ ਵੈਸ਼ਨੂੰ ਮਹਾਰਾਜਾ ਹੋਟਲ ਤੋਂ ਹਾਂ ਤੁਹਾਨੂੰ ਅਗਰ ਤੁਸੀਂ ਵਹੀਕਲ 'ਤੇ ਆਏ ਹੋ ਕਿ ਬੱਸ 'ਤੇ ਆਏ ਹੋ ਜਾਂ ਆਪਣੇ ਵਹੀਕਲ 'ਤੇ ਆਏ ਹੋ ਬਸ ਆਪਣੇ ਵਹੀਕਲ 'ਤੇ ਫਿਰ ਤੁਸੀਂ ਆਰਾਮ ਨਾਲ ਤੁਹਾਨੂੰ ਪੰਜ ਪੰਜ ਮਿੰਟ ਛੇ ਛੇ ਮਿੰਟ ਦਸ ਦਸ ਮਿੰਟ ਦੇ ਰਸਤੇ 'ਚ ਮਿਲ ਜਾਣੇ ਸਾਰੇ ਹੋਟਲ ਹੈਗੇ ਆ ਬਹੁਤ ਵਧੀਆ ਇੱਥੇ ਇੱਕ ਅਗਰ ਡਿੱਨਰ ਲਈ ਨਹੀਂ ਬੇਸਿਕਲੀ ਜਾਣਾ ਡਿੱਨਰ ਲਈ ਨਵਾਂ ਖੁਲ੍ਹਿਆ ਸਾਡੇ ਇੱਥੇ ਰੋਕਾ ਰੋਕਾ ਪ੍ਰਾਈਜ਼ ਲਈ ਵੀ ਠੀਕ ਆ ਰੀਜਨੇਬਲ ਆ ਪਰ ਉਹਦੇ ਕੋਲ ਰੋਕਾ ਨਾਲ ਹੀ ਆ ਰੋਕਾ ਇੰਨਾ ਨਹੀਂ ਹੈ ਰੀਨਿਊ ਪਾਰਕ ਆ ਨਾ ਜਿੱਥੇ ਸਾਡਾ ਹੋਸ਼ਿਆਰਪੁਰ ਦਾ ਹੈਗਾ ਰੀਨਿਊ ਪਾਰਕ ਰੀਨਿਊ ਪਾਰਕ ਦੇ ਸਾਹਮਣੇ ਹੈਗਾ ਬਿਲਕੁਲ ਰੋਕਾ ਇੱਥੇ ਪੈਟਰੋਲ ਪੰਪ ਵੀ ਹੈਗਾ ਉਹਦੇ ਸਾਹਮਣੇ ਬਿਲਕੁਲ ਰੋਕਾ ਚੌਂਕ ਨੂੰ ਜਾਂਦੀ ਹੈ ਇਹ ਗਲੀ ਉੱਥੋਂ ਪਹਿਲਾਂ ਹੀ ਹੈ ਰੋਕਾ ਉੱਥੇ ਮੇ ਉੱਥੇ ਮੇਨ ਬੇਸੀਕਲੀ ਨਾ ਉਹ ਡਿਨਰ ਲਈ ਬਣਾਇਆ ਹੋਇਆ ਤੁਸੀਂ ਡਿਨਰ ਕਰਨਾ ਤਾਂ ਅਗਰ ਤੁਸੀਂ ਨਾਸ਼ਤਾ ਵਗੈਰਾ ਕਰਨਾ ਤਾਂ ਮਹਾਰਾਜਾ ਹੋਟਲ ਦੇ ਨਾਲ ਬਿਲਕੁਲ ਸਾਹਮਣੇ ਥੋੜ੍ਹਾ ਅੱਗੇ ਜਾ ਕੇ ਖੁੱਲਿਆ ਹੋਇਆ ਪਰਾਂਠਾ ਜੰਕਸ਼ਨ ਨਵਾਂ ਪਰਾਂਠਾ ਅਗਰ ਤੁਸੀਂ ਨਾਸ਼ਤਾ ਵਗੈਰਾ ਕਰਨਾ ਤਾਂ ਉੱਥੇ ਮੰਗਵਾ ਸਕਦੇ ਹੋ ਨਵੇਂ ਖੁਲ੍ਹਿਆ ਸੀ ਠੀਕ ਆ ਉਹਦੇ ਰੇਟ ਹਾਂ ਪ੍ਰਾਈਜਜ ਠੀਕ ਆ ਉਹਦੇ ਕੋਲ ਬੇਸਿਕ ਜਿਹੇ ਅਲੱਗ ਅਲੱਗ ਤਰ੍ਹਾਂ ਦੇ ਪਰਾਂਠੇ ਵੀ ਹੈ ਪੈਸੇ ਵੀ ਠੀਕ ਆ ਅਤੇ ਅਗਰ ਤੁਸੀਂ ਲੰਚ ਲਈ ਜਾਣਾ ਅਗਰ ਦਾਲ ਵਗੈਰਾ ਖਾਣੀ ਹੈ ਤੁਸੀਂ ਜੰਦਾ ਵੈਸ਼ਨੂੰ ਢਾਬਾ ਜਾ ਸਕਦੇ ਹੋ ਰਾਮ ਵਾਲੇ ਵੈਸ਼ਨੂੰ ਵੀ ਜਾ ਸਕਦੇ ਉਹ ਵੀ ਠੀਕ ਹੈ ਬੈਠਣ ਨੂੰ ਜਗ੍ਹਾ ਹੈਗੀ ਇੱਥੇ ਰਾਮ ਵਾਲੇ ਦੇ ਢਾਬੇ 'ਚ ਨਹੀਂ ਜਾਣਾ ਤਾਂ ਰਾਮਾ ਵਾਲੇ ਵੈਸ਼ਨੂੰ ਜਾ ਸਕਦੇ ਹੋ ਤੁਸੀਂ ਉੱਥੇ ਵੈਜੀਟੇਰੀਅਨ ਫੂਡ ਹੀ ਆ ਸਾਰੀ ਜਗ੍ਹਾ ਮੇਨ ਬੇਸਿਕਲੀ ਆਟੋਮੋਟ ਜਾ ਸਕਦੇ ਰੀਜਨੇਬਲ ਰੇਟ ਆ ਆਟੋਮੋਟ ਆਟੋਮੈਟ ਤੁਹਾਨੂੰ ਪੈ ਜਾਣਾ ਓਟੋਮੋਟ ਨਾ ਤੁਹਾਨੂੰ ਜਿਹੜਾ ਸ਼ੈਸਨ ਚੋਂਕ ਆ ਨਾ ਉਥੇ ਟੱਪੁਗੇ ਨਾ ਸ਼ਿਮਲਾਵਾਰੀ ਚੋਂਕ ਵੱਲ ਨੂੰ ਆਓਗੇ ਸ਼ਿਮਲਾਬਾਰੀ ਚੋਂਕ ਵੱਲ ਨੂੰ ਜਦੋਂ ਆਓਗੇ ਸ਼ਿਮਲਾਬਾਰੀ ਚੋਂਕ 'ਚੋਂ ਨਾ ਤੁਸੀਂ ਵੱਲ ਨੂੰ ਹੋ ਜਾਣਾ ਉੱਥੋਂ ਪੁੱਛ ਲਓ ਵੀ ਕਿੱਥੇ ਆ ਅਤੇ ਗੂਗਲ 'ਤੇ ਲੋਕੇਸ਼ਨ ਖੋਲ੍ਹ ਲਿਓ ਔਟੋਮੋਡ ਵੀ ਖੋਲ੍ਹ ਲਿਓ ਡਰੈਕਟ ਤਾਂ ਆ ਜਾਣਾ ਉੱਥੋਂ ਔਟੋਮੋਡ ਬਿਲਕੁਲ ਨੇੜੇ ਆ ਮਿਡੇਲਿਅਨ ਹੋਟਲ ਦੇ ਸਾਹਮਣੇ ਔਟੋਮੋਡ ਆ ਥੱਲ੍ਹੇ ਜਾ ਕੇ ਥੱਲ੍ਹੇ ਥੱਲ੍ਹੇ ਜਿਹੇ ਹਾਂ ਥੱਲ੍ਹੇ ਜਾ ਕੇ ਉਹਦੀ ਡਾਇਨਿੰਗ ਹੈਗੀ ਆ ਉੱਥੇ ਮਿਲ ਜਾਣੀ ਜਗ੍ਹਾ ਆਰਾਮ ਨਾਲ ਆਟੋਮੋਡ ਠੀਕ ਸਹੀ ਖਾਣਾ ਉੱਥੇ ਵੀ ਅਤੇ ਘੁੰਮਣ ਨੂੰ ਤੁਹੀਂ ਹੁਸ਼ਿਆਰਪੁਰ ਤਾਂ ਮੇਨ ਬੇਸਿਕਲੀ ਤੁਸੀਂ ਅਗਰ ਤੁਹਾਨੂੰ ਵਿਊ ਵਿਯੂ ਵਧੀਆ ਚਾਹੀਦਾ ਫੋਟੋਆਂ ਹੋਣ ਜਿਹਨੂੰ ਤੁਸੀਂ ਨੂੰ ਚੋਹਾਲ ਵੱਲ ਨੂੰ ਜਾ ਸਕਦੇ ਜਿਹਨੂੰ ਤੁਸੀਂ ਹਿਲ ਗੜਨ ਦੇਖਣ ਹਿਲ ਗਾਰਡਨ ਦੇਖ ਸਕਦੇ ਤੁਸੀਂ ਨੈਚੁਰਲ ਲੇਕ ਵੀ ਜਾ ਸਕਦੇ ਉੱਥੇ ਬੋਟਿੰਗ ਵਗੈਰਾ ਵੀ ਹੈਗੀ ਹੈ ਹੁਸ਼ਿਆਰਪੁਰ 'ਚ ਤਾਂ ਬੋਟਿੰਗ ਵਗੈਰਾ ਵੀ ਹੈਗੀ ਹੁਣ ਨੈਚਰਲ ਗਰੀਨ ਵੀ ਜਾ ਸਕਦੇ ਤੁਸੀਂ ਅਗਰ ਤੁਸੀਂ ਕਿਸੀ ਮ ਮੰਦਰ ਇੱਥੇ ਹੈਗੀ ਆ ਚੌਹਾਲ ਤੋਂ ਥੋੜ੍ਹਾ ਅੱਗੇ ਜਾ ਚੌਹਾਲ ਤੋਂ ਪਹਿਲੇ ਹੀ ਵੈਸ਼ਨੋ ਮਾਤਾ ਦੀ ਗੁਫਾ ਆਉਂਦੀ ਆ ਉੱਥੇ ਜਾ ਸਕਦੇ ਹੋ ਘੁੰਮਣ ਮੱਥਾ ਮੁੱਥਾ ਟੇਕ ਲਵਾਂਗੇ ਇੱਥੇ ਤਾਂ ਉੱਥੇ ਜਾ ਕੇ ਤੁਸੀਂ ਅਤੇ ਉਹ ਵੀ ਤੁਹਾਨੂੰ ਠੀਕ ਆ ਘੁੰਮਣ ਨੂੰ ਹੋਰ ਤੁਹਾਨੂੰ ਤੁਹੀਂ ਨਾਹਰ ਡੈਮ ਜਾ ਸਕਦੇ ਇੱਥੇ ਹੈਗਾ ਨਾਹਰ ਡੈਮ ਵੀ ਜਾ ਸਕਦੇ ਤੁਸੀਂ ਹੋਰ ਬਸ ਇਹ ਹੀ ਐ ਤੁਸੀਂ ਕਿੰਨੇ ਕੁ ਦਿਨ ਲਈ ਮੈਂ ਵੈਸੇ ਇੱਥੇ ਉਸ ਹਿਸਾਬ ਨਾ ਬਣਾ ਲਵਾਂ ਰੁਟੀਨ ਪੂਰੀ ਦਸ ਕੁ ਦਿਨ ਤਾਂ ਹਾਂ ਤੁਸੀਂ ਆਰਾਮ ਨਾਲ ਘੁੰਮ ਸਕਦੇ ਜੇ ਇੱਥੇ ਸੰਡੇ ਨੂੰ ਮਾਰਕਿਟ ਲੱਗਦੀ ਉੱਥੇ ਵੀ ਘੁੰਮਣ ਜਾ ਸਕਦੇ ਤੁਸੀਂ ਸੰਡੇ ਮਾਰਕੀਟ ਘੁੰਮਣ ਜਾ ਸਕਦੇ ਹਰ ਜਗ੍ਹਾ 'ਤੇ ਘੁੰਮਣ ਜਾ ਸਕਦੇ ਖਾਣਾ ਵਗੈਰਾ ਠੀਕ ਹੈ ਨਾ ਇੱਥੇ ਰੈਸਟੋਰੈਂਟ ਫੇਮਸ ਹੈਗੇ ਬਹੁਤ ਅਗਰ ਤੁਹਾਨੂੰ ਕੋਈ ਪਰੇਸ਼ਾਨੀ ਦੁਬਾਰਾ ਆਉਗੀ ਤੁਸੀਂ ਮੈਨੂੰ ਕਦੇ ਵੀ ਕਾਲ ਕਰ ਲਿਓ ਮੈਂ ਚੁੱਕ ਲਊਂਗਾ ਅਗਰ ਤੁਹਾਨੂੰ ਅਰੇਂਜਮੈਂਟ ਕਰਨੀ ਉਹ ਵੀ ਮੈਂ ਬੰਦਾ ਭੇਜ ਦਊਂਗਾ ਆਪਣਾ ਉਹ ਤੁਹਾਨੂੰ ਲੈ ਜਾਊਗਾ ਅਗਰ ਤੁਹਾਨੂੰ ਕੋਈ ਲੋੜ ਪਈ ਤਾਂ ਬਾਕੀ ਦੱਸ ਦਿਓ ਮੈਨੂੰ ਖਾਣੇ ਜਗ੍ਹਾ ਹੈਗੀ ਮੇਨ ਫੇਮਸ ਸਾਰੇ ਰੈਸਟੋਰੈਂਟ ਹੈਗੇ ਆ ਬ੍ਰਾਹਮਣ ਰੇਸਟੋਰੈਂਟ ਜਾ ਆਇਓ ਰੋਕਾ ਜਾ ਆਇਓ ਕੋਈ ਨਹੀਂ ਬਾਕੀ ਨੂੰ ਫੋਨ ਕਰ ਲਈਂ ਕੋਈ ਨਹੀਂ ਠੀਕ ਕੋਈ ਨਹੀਂ ਠੀਕ ਠੀਕ ਹੈ ਜੀ ਬਾਏ ਬਾਏ ਜੀ